ਮੈਨੂੰ ਤਕਨੀਕੀ ਸੰਬੰਧਤ ਕਾਫੀ ਹੁਨਰਾਂ ਵਿੱਚ ਦਿਲਚਸਪੀ ਹੈ ਜਿਸ ਤਰ੍ਹਾਂ ਵੈੱਬ ਡਿਵੈਲਪਮੈਂਟ ਐਪ ਅਤੇ ਹੋਰ ਇਹੋ ਜਿਹੀਆ ਚੀਜ਼ਾਂ ਜੋ ਆਮ ਲੋਕਾਂ ਲਈ ਵਰਤੋਂ ਵਿੱਚ ਆਉਂਦੀ ਹਨ ਇਹ ਸਬ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਇਹਨਾਂ ਸਭ ਨੂੰ ਸਿੱਖਣ ਲਈ ਇੰਟਰਨੈਟ ਉੱਤੇ ਕਾਫੀ ਸਾਰੇ ਸਾਧਨ ਹਨ ਜਿਵੇਂ ਹੀ ਕਾਫੀ ਸਾਰੇ ਇਹੋ ਜਿਹੇ ਕੋਰਸ ਸ਼ਾਮਿਲ ਹਨ ਜਿਨਾਂ ਨੂੰ ਜਿਨਾਂ ਵਿੱਚ ਅਸੀਂ ਕਿਸੇ ਅਧਿਆਪਕ ਨੂੰ ਪੈਸੇ ਦੇ ਕੇ ਉਹਨਾਂ ਤੋਂ ਆਨਲਾਈਨ ਚੀਜ਼ਾਂ ਸਮਝ ਸਕਦੇ ਆਂ ਇਸ ਤੋਂ ਇਲਾਵਾ ਕਾਫੀ ਸਾਰੇ ਇਹੋ ਜਿਹੀਆਂ ਵੈੱਬਸਾਈਟਾਂ ਹਨ ਜਿਹੜੇ ਸਾਨੂੰ ਬਿਨਾਂ ਕਿਸੇ ਪੈਸੇ ਦੇ ਸਿੱਖਣ ਵਿੱਚ ਮਦਦ ਤਾਂ ਕਰਦੀਆਂ ਹੀ ਹਨ ਇਸ ਤੋਂ ਇਲਾਵਾ ਆਪਣੇ ਨਿਜੀ ਪ੍ਰੋਜੈਕਟ ਬਣਾਉਣ ਵਿੱਚ ਵੀ ਸਹਾਇਤਾ ਕਰਦੀਆਂ ਹਨ ਇਹਨਾਂ ਸਭ ਦੀ ਵਰਤੋਂ ਨਾਲ ਅਸੀਂ ਕਾਫੀ ਸਾਰੀ ਤਕਨੀਕਾਂ ਬਾਰੇ ਸਿੱਖ ਸਕਦੇ ਹਾ